ਸਾਡੇ ਭਾਈਚਾਰੇ ਦਾ ਧਾਰਮਿਕ ਆਗੂ ਮੈਂ ਮੈਂ ਜਸਵਿੰਦਰ ਸਿੰਘ ਜੀ ਨੂੰ ਮੰਨਦੀ ਹਾਂ ਉਹਨਾਂ ਉਹਨਾਂ ਨੇ ਸਾਡੇ ਪਰਿਵਾਰ ਵਿੱਚ ਮੇਰੇ ਡੈਡੀ ਜੀ ਨੂੰ ਸਲਾਹ ਦਿੱਤੀ ਸੀ ਕਿ ਉਹ ਵੀ ਅੰਮ੍ਰਿਤ ਛਕ ਲੈਣ ਅਤੇ ਤਬਲਾ ਵਜਾਉਣਾ ਸਿੱਖ ਲੈਣ ਤਾਂ ਜੋ ਉਹਨਾਂ ਨੂੰ ਬਾਹਰ ਵੀ ਜੈਸ ਜਿਸ ਨਾਲ਼ ਬਾਹਰ ਵੀ ਜਾ ਸਕਦੇ ਹਨ ਬਾਹਰ ਘੁੰਮਣ ਦਾ ਉਹਨਾਂ ਨੂੰ ਮੌਕਾ ਮਿਲ ਸਕਦਾ ਹੈ ਅਤੇ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਉਹਨਾਂਂ ਨੇ ਇਹ ਸਲਾਹ ਦਿੱਤੀ ਸੀ ਉਹਨਾਂ ਨੇ ਸਲਾਹ ਦਿੱਤੀ ਸੀ ਕਿ ਵੀ ਪਾਠ ਵੀ ਕਰਿਆ ਕਰਨ ਅਤੇ ਹੋਰ ਵੀ ਧਾਰਮਿਕ ਧਾਰਮਿਕ ਪ੍ਰਕਿਰਿਆ ਕਰਨ ਕਰਨ ਜਿਸ ਨਾਲ਼ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੋਵੇਗੀ